ਟਰੈਕਿੰਗ ਟਰੈਕਿੰਗ ਜਾਂ ਹਾਈਕਿੰਗ ਦਾ ਅਰਥ ਹੁੰਦਾ ਹੈ ਪੈਦਲ ਯਾਤਰਾ ਕਰਨਾ ਪਹਾੜਾਂ ਜਾਂ ਕਿਸੇ ਐਸੇ ਸਥਾਨਾਂ 'ਤੇ ਜਿੱਥੇ ਤੁਸੀਂ ਪੈਦਲ ਹੀ ਜਾ ਸਕਦੇ ਹੋ ਪਹਾੜ ਚੜ੍ਹਨਾ ਵੀ ਟਰੈਕਿੰਗ ਦਾ ਹੀ ਇੱਕ ਪਾਰਟ ਹੈ ਇਸ ਵਿੱਚ ਤੁਸੀਂ ਪੈਦਲ ਯਾਤਰਾ ਕਰਦੇ ਹੋ ਜੇਕਰ ਤੁਸੀਂ ਆਪਣੀ ਟੀਮ ਨਾਲ ਗਏ ਹੋ ਤਾਂ ਉਹਨਾਂ ਵਿੱਚ ਟੀਮ ਵਰਕ ਵੀ ਵੱਧਦਾ ਹੈ ਇੱਕ ਦੂਜੇ ਨਾਲ ਮੇਲ ਜੋਲ ਵੱਧਦੀ ਹੈ ਅਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਦੇ ਕਈ ਵਾਰ ਕੈਂਪ ਵੀ ਲੱਗਦੇ ਹਨ ਅਤੇ ਇਸ ਵਿੱਚ ਚੀਜ਼ਾਂ ਸਿਖਾਈ ਵੀ ਜਾਂਦੀਆਂ ਹਨ ਮੈਨੂੰ ਵੀ ਟਰੈਕਿੰਗ ਦਾ ਸ਼ੌਂਕ ਹੈ ਕਿ ਉਹ ਕੀ ਇੱਕ ਵਾਰ ਮੈਂ ਆਪਣੇ ਪਿਤਾ ਜੀ ਨਾਲ ਟਰੈਕਿੰਗ ਲਈ ਗਈ ਸੀ ਅਤੇ ਇੱਕ ਵਾਰ ਸਾਡਾ ਸਮਰ ਕੈਂਪ ਵੀ ਲੱਗਿਆ ਸੀ ਇਸ ਲਈ ਮੇਰੇ ਕੋਲ ਟਰੈਕਿੰਗ ਦਾ ਸਾਰਾ ਸਮਾਨ ਵੀ ਹੈ ਟਰੈਕਿੰਗ ਜਾਂ ਹਾਈਕਿੰਗ ਕਰਨ ਵੇਲੇ ਇੱਕ ਬੰਦੇ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਪੂਰੀ ਤਰ੍ਹਾ ਤੰਦਰੁਸਤ ਹੋ ਕੋਈ ਵੀ ਬਿਮਾਰ ਆਦਮੀ ਜਾਂ ਫਿਰ ਜਿਸ ਨੂੰ ਦਿਲ ਦੀ ਬਿਮਾਰੀ ਹੋ ਉਹ ਟਰੈਕਿੰਗ ਲਈ ਉਹ ਟਰੈਕਿੰਗ ਲਈ ਅ ਅਸਫਲ ਹੋ ਜਾਂਦਾ ਹੈ ਇਸ ਲਈ ਇੱਕ ਤੰਦਰੁਸਤ ਇਨਸਾਨ ਨੂੰ ਹੀ ਟਰੈਕਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ ਟਰੈਕਿੰਗ ਹਰ ਕਿਸੇ ਦੀ ਹੋਬੀ ਨਹੀਂ ਹੁੰਦੀ ਪਰ ਜਿਨ੍ਹਾਂ ਲੋਕਾਂ ਨੂੰ ਟਰੈਕਿੰਗ ਵੱਲ ਧਿਆਨ ਹੁੰਦਾ ਹੈ ਉਹਨਾਂ ਨੂੰ ਇਹ ਬਹੁਤ ਚੰਗੀ ਲੱਗਦੀ ਹੈ ਅੱਜ ਕੱਲ੍ਹ ਦੇ ਜਮਾਨੇ ਵਿੱਚ ਤਾਂ ਯੂਟੀਊਬ 'ਤੇ ਇਸ ਬਾਰੇ ਬਹੁਤ ਜ਼ਿਆਦਾ ਦੱਸਦੇ ਹਨ ਇਸ ਦਾ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਕਿੱਦਾਂ ਕੀਤੀ ਜਾ ਸਕਦੀ ਹੈ ਕਿੱਥੇ ਕਿੱਥੇ ਕੀਤੀ ਜਾ ਸਕਦੀ ਆ ਅਤੇ ਇਸ ਵਿੱਚ ਇਸਤੇਮਾਲ ਹੋਣ ਵਾਲੇ ਸਾਜ ਸਮਾਨ ਦੇ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਕੋਲ ਜਾਣ ਲਈ ਇੱਕ ਬੈਗ ਪੈਕ ਹੋਣਾ ਬਹੁਤ ਜ਼ਰੂਰੀ ਹੈ ਬੈਗ ਪੈਕ ਵਿੱਚ ਹੀ ਅਸੀਂ ਆਪਣਾ ਸਾਰਾ ਸਮਾਨ ਪਾਉਂਦੇ ਹਾਂ ਬੈਗ ਪੈਕ ਦੇ ਨਾਲ ਨਾਲ ਸਾਡੇ ਕੋਲ ਇਕ ਸਲੀਪਿੰਗ ਬੈਗ ਹੋਣਾ ਵੀ ਬਹੁਤ ਜ਼ਰੂਰੀ ਹੈ ਸਲੀਪਿੰਗ ਬੈਗ ਦਾ ਅਰਥ ਹੁੰਦਾ ਹੈ ਇੱਕ ਬੈਗ ਜਿਸ ਵਿੱਚ ਅਸੀਂ ਰਾਤ ਨੂੰ ਟਰੈਕਿੰਗ ਦੇ ਵੇਲੇ ਸੋ ਸਕਦੇ ਹਾਂ ਇਸ ਦੇ ਨਾਲ ਨਾ ਹੀ ਤਾਂ ਕੋਈ ਜੰਗਲੀ ਜਾਨਵਰ ਸਾਡੇ 'ਤੇ ਹਮਲਾ ਕਰ ਸਕਦਾ ਹੈ ਅਤੇ ਨਾਲ ਹੀ ਅਸੀਂ ਸੁਰੱਖਿਅਤ ਤਰੀਕੇ ਨਾਲ ਸੋ ਵੀ ਸਕਦੇ ਹਾਂ ਇਸ ਦੇ ਨਾਲ ਨਾਲ ਹੀ ਕਈ ਵਾਰ ਅਸੀਂ ਕੈਂਪ ਫਾਇਰ ਕਰਦੇ ਹਾਂ ਜਾਂ ਫਿਰ ਟੈਂਟ ਵੀ ਲਗਾ ਲੈਂਦੇ ਹਾਂ ਕਈ ਵਾਰ ਅਸੀਂ ਸਾਰੀ ਸਾਰੀ ਰਾਤ ਨਾ ਸੋ ਕੇ ਜਦੋਂ ਜ਼ਿਆਦਾ ਲੋਕਾਂ ਨਾਲ ਹੋਵੇ ਤਾਂ ਰਾਤ ਨੂੰ ਗੱਲਾਂ ਬਾਤਾਂ ਆਦਿ ਵੀ ਕਰਦੇ ਹਾਂ ਇਸ ਵਿੱਚ ਵੀ ਬਹੁਤ ਮਜ਼ਾ ਆਉਂਦਾ ਹੈ ਖਾਣ ਪੀਣ ਦੀਆਂ ਕੁਝ ਅਜਿਹੀਆਂ ਚੀਜ਼ਾਂ ਜੋ ਹਰ ਕਿਤੇ ਉਪਲੱਬਧ ਨਹੀਂ ਹੁੰਦੀਆਂ ਸਾਨੂੰ ਨਾਲ ਰੱਖ ਲੈਣੀ ਚਾਹੀਦੀਆਂ ਹਨ ਜਿੱਦਾਂ ਕਿ ਸੁੱਕਾ ਆ ਖਾਣ ਪੀਣ ਦਾ ਸਮਾਨ ਜਿੰਨਾ ਹੋ ਸਕੇ ਅਸੀਂ ਨਾਲ ਲੈ ਲਈਏ ਪਰ ਇੰਨਾ ਵੀ ਨਹੀਂ ਕਿ ਬੈਗ ਭਾਰੀ ਹੋ ਜਾਵੇ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਦੀ ਕਮੀ ਦੇ ਨਾਲ ਵੀ ਇਨਸਾਨ ਬਿਮਾਰ ਹੋ ਸਕਦਾ ਹੈ ਇਸ ਦੇ ਨਾਲ ਨਾਲ ਸਾਨੂੰ ਫਸਟ ਏਡ ਕਿਟ ਦਾ ਹੋਣਾ ਬਹੁਤ ਜ਼ਰੂਰੀ ਆ ਫਸਟ ਏਡ ਕਿਟ ਵਿੱਚ ਤੁਸੀਂ ਪੇਟ ਦਰਦ ਸਿਰ ਦਰਦ ਉਲਟੀਆਂ ਵਗੈਰਾ ਦੀ ਗੋਲੀ ਰੱਖ ਸਕਦੇ ਹੋ ਕਿਉਂਕਿ ਪਹਾੜਾਂ ਦੇ ਮੌਸਮ ਤੇ ਘੁੰਮ ਫਿਰਾ ਕਰਕੇ ਤਬੀਅਤ ਖਰਾਬ ਹੋ ਸਕਦੀ ਹੈ ਨਾਲ ਹੀ ਰੂੰ ਅਤੇ ਬੀਟਾਡੀਨ ਜਿਹੀ ਕੋਈ ਦਵਾਈ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਕੋਈ ਇਨਸਾਨ ਡਿੱਗ ਜਾਵੇ ਜਾਂ ਕਿਸੇ ਦੇ ਸੱਟ ਲੱਗ ਜਾਵੇ ਤਾਂ ਇਸ ਦੀ ਬਹੁਤ ਅਵਸ਼ਕਤਾ ਪੈਂਦੀ ਹੈ ਨਾਲ ਹੀ ਤੁਸੀਂ ਟਰੈਕਿੰਗ ਰੋਪਸ ਅਤੇ ਟਰੈਕਿੰਗ ਪੋਲਸ ਲੈਣੇ ਹੁੰਦੇ ਹਨ ਇਹ ਹੁੰਦੇ ਹੈ ਕਿ ਜੋ ਪਹਾੜ ਚੜ੍ਹਨ ਵਿੱਚ ਮਦਦ ਕਰਦੇ ਹਨ ਰੋਪਸ ਨੂੰ ਚੰਗੀ ਗ੍ਰਿਪ ਨਾਲ ਫੜਨ ਲਈ ਅਸੀਂ ਨਾਲ ਦਸਤਾਨੇ ਵੀ ਰੱਖ ਲੈਂਦੇ ਹਾਂ ਅਤੇ ਪਹਾੜ ਚੜ੍ਹਨ ਲਈ ਜੋ ਬੂਟ ਇਸਤੇਮਾਲ ਕੀਤੇ ਜਾਂਦੇ ਹਨ ਉਹਨਾਂ ਨੂੰ ਹਾਈਕਿੰਗ ਬੂਟਸ ਕਿਹਾ ਜਾਂਦਾ ਹੈ ਗਰਮ ਕੱਪੜੇ ਲੈਣੇ ਵੀ ਜ਼ਰੂਰੀ ਹਨ ਜੇਕਰ ਉਸ ਵੇਲੇ ਠੰਡ ਹੋ ਜਾਵੇ ਤਾਂ ਜੰਗਲਾਂ ਵਿੱਚ ਕੁਝ ਵੀ ਨਹੀਂ ਮਿਲਦਾ ਅੱਜ ਕੱਲ੍ਹ ਦੇ ਦੌਰ ਵਿੱਚ ਹਾਲਾਂਕਿ ਕੁਝ ਕੁਝ ਦੁਕਾਨਾਂ ਮਿਲ ਜਾਂਦੀਆਂ ਹਨ ਪਰ ਫਿਰ ਵੀ ਪਹਾੜਾਂ ਵਿੱਚ ਬਾਕੀ ਸਹੂਲੀਅਤ ਹੋਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਟਰੈਕਿੰਗ ਦਾ ਅਰਥ ਹੀ ਅਜਿਹਾ ਹੈ ਕਿ ਸਹੂਲਤਾਂ ਨੂੰ ਛੱਡ ਕੇ ਅਸੀਂ ਜੇ ਆਪਣੇ ਅਸੀਂ ਜੇ ਬਿਨਾਂ ਆਪਣੀ ਸਹੂਲਤਾਂ ਦੇ ਰਹਿਣਾ ਸਿੱਖ ਜਾਈਏ ਤਾਂ ਅਸੀਂ ਜੀਵਨ ਵਿੱਚ ਸਫਲ ਹਾਂ ਇਸ ਲਈ ਸਾਨੂੰ ਆਪਣੀ ਜ਼ਰੂਰਤਾਂ ਦਾ ਧਿਆਨ ਆਪ ਹੀ ਰੱਖਣਾ ਪੈਂਦਾ ਹੈ ਅਤੇ ਜੇ ਆਪਣੀ ਕੋਈ ਮੁਸ਼ਕਿਲ ਹੋ ਜਾਵੇ ਤਾਂ ਉਸ ਨਾਲ ਕਿੱਦਾਂ ਜੂਝਣਾ ਹੈ ਇਹ ਸਿੱਖ ਸਕਦੇ ਹਾਂ ਟਰੈਕਿੰਗ ਦਾ ਸਾਰਾ ਸਮਾਨ ਸ਼ਹਿਰ ਵਿੱਚੋਂ ਕਿਸੇ ਵੀ ਚੰਗੀ ਟਰੈਕ ਵਾਲੀ ਦੁਕਾਨ ਤੋਂ ਮਿਲ ਸਕਦਾ ਹੈ ਅਤੇ ਕੱਪੜੇ ਵਗੈਰਾ ਵੀ ਕੱਪੜਿਆਂ ਦੀ ਦੁਕਾਨ ਤੋਂ ਮਿਲ ਜਾਂਦੇ ਹਨ ਕਈ ਵਾਰ ਜਿੱਥੋਂ ਦੀ ਫੌਜੀ ਆਦਿ ਸਮਾਨ ਖਰੀਦਦੇ ਹਨ ਉੱਥੋਂ ਦੀ ਵੀ ਟਰੈਕਿੰਗ ਦਾ ਸਾਰਾ ਸਮਾਨ ਮਿਲ ਸਕਦਾ ਹੈ ਇਸ ਕਰਕੇ ਸ਼ਹਿਰਾਂ ਵਿੱਚ ਤਾਂ ਇਸ ਲਈ ਕੋਈ ਔਖ ਨਹੀਂ ਹੁੰਦੀ ਫਿਰ ਵੀ ਕੋਈ ਅਜਿਹੀ ਸਮੱਸਿਆ ਆ ਜਾਵੇ ਤਾਂ ਸਾਰਾ ਸਮਾਨ ਔਨਲਾਈਨ ਆਰਡਰ ਕੀਤਾ ਜਾ ਸਕਦਾ ਹੈ ਔਨਲਾਈਨ ਵਿੱਚ ਵੀ ਅੱਜ ਕੱਲ੍ਹ ਡਿਲੀਵਰੀ ਬਹੁਤ ਤੇਜ਼ ਹੋ ਗਈ ਹੈ ਅਤੇ ਹਰ ਸਮਾਨ ਚੰਗੀ ਕੁਆਲਿਟੀ ਦਾ ਮਿਲ ਜਾਂਦਾ ਹੈ ਇਸ ਕਰਕੇ ਅਸੀਂ ਟਰੈਕਿੰਗ ਦਾ ਸਮਾਨ ਔਨਲਾਈਨ ਵੀ ਆਰਡਰ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਸਾਨੂੰ ਨਾਲ ਲੈ ਕੇ ਜਾਣ ਲਈ ਇੱਕ ਮੈਗਨੈਟਿਕ ਕੰਪਸ ਦੀ ਬਹੁਤ ਅਵਸ਼ਕਤਾ ਹੁੰਦੀ ਹੈ ਮੈਕਨੈਟਿਕ ਕੰਪਸ ਦਾ ਕੰਮ ਹੈ ਦਿਸ਼ਾ ਦਿਖਾਉਣਾ ਜੇਕਰ ਕੋਈ ਦਿਸ਼ਾ ਭਟਕ ਜਾਵੇ ਤਾਂ ਉਸ ਨਾਲ ਪਤਾ ਕਰ ਸਕਦਾ ਹੈ ਨਾਲ ਹੀ ਅਸੀਂ ਅੱਜ ਕੱਲ੍ਹ ਤਾਂ ਮੋਬਾਈਲ ਹਨ ਨਹੀਂ ਤਾਂ ਨੈਟਵਰਕ ਨਾ ਹੋਵੇ ਤਾਂ ਵੋਕੀ ਟੋਕੀ ਜਾਂ ਕੁਝ ਇੱਦਾਂ ਦਾ ਸੰਬੰਧਕ ਪਦਾਰਥ ਰੱਖ ਸਕਦੇ ਹਾਂ ਜਿਸ ਨਾਲ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹਾਂ ਕਦੇ ਕਿਸੇ ਤੋਂ ਉਰੇ ਪਰੇ ਹੋ ਜਾਵੇ ਤਾਂ ਵਾਪਿਸ ਮਿਲ ਸਕਦੇ ਹਾਂ ਇਹ ਸਮਾਨ ਟਰੈਕਿੰਗ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕੋਈ ਵੀ ਘੱਟ ਧੜਕਣ ਵਾਲਾ ਇਨਸਾਨ ਟਰੈਕਿੰਗ ਲਈ ਟਰੈਕਿੰਗ ਲਈ ਜ ਹਾਮੀ ਨਹੀਂ ਭਰਦਾ ਇੱਕ ਤੰਦਰੁਸਤ ਵਿਅਕਤੀ ਨੂੰ ਹੀ ਇਹੋ ਜਿਹੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ ਅਤੇ ਇਸ ਦੇ ਨਾਲ ਨਾਲ ਇਸ ਨਾਲ ਸਾਨੂੰ ਹੋਰ ਵੀ ਬੜੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਟਰੈਕਿੰਗ ਵਿੱਚ ਅਸੀਂ ਕੁਝ ਅਜਿਹੇ ਜਾਨਵਰ ਜਾਂ ਛੋਟੇ ਛੋਟੇ ਛੋਟੇ ਕੀੜੇ ਮਕੌੜੇ ਅਜਿਹੇ ਦੇਖਦੇ ਹਾਂ ਜੋ ਅੱਜ ਕੱਲ੍ਹ ਵਿਲੁਪਤ ਹੋ ਚੁੱਕੇ ਹਨ ਪਰ ਪਹਾੜਾਂ ਵਿੱਚ ਉਹਨਾਂ ਦੀ ਸ਼੍ਰੇਣੀ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਬਚੀ ਹੈ ਇਸ ਲਈ ਇਹ ਸਾਇੰਟਿਫਿਕਲੀ ਵੀ ਇਹ ਰਿਸਰਚ ਲਈ ਟਰੈਕਿੰਗ ਵਗੈਰਾ ਕੀਤੀ ਜਾਂਦੀ ਹੈ ਟਰੈਕਿੰਗ ਦੇ ਬਾਰੇ ਅਜਿਹੀ ਜਾਣਕਾਰੀ ਅਤੇ ਸਾਜ ਸਮਾਨ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਟਰੈਕਿੰਗ ਕਰਦੇ ਹੋ